ਬਿਜਲੀ ਦੇ ਕੱਟ ਸਾਡੇ ਪੰਜਾਬੀਆਂ ਦੇ ਘਰ ਲੁਧਿਆਣੇ ਵਿੱਚ ਬਹੁਤ ਘੱਟ ਨੇ ਜੇ ਕਿਤੇ ਬਿਜਲੀ ਚਲੀ ਵੀ ਜਾਂਦੀ ਹੈ ਤਾਂ ਮੀਂਹ ਹਨੇਰੀ ਕਾਰਨ ਕੱਟ ਲੱਗਦਾ ਹੈ ਤਾਂ ਬਹੁਤ ਪ੍ਰੇਸ਼ਾਨੀ ਹੁੰਦੀ ਹੈ ਸਾਰੇ ਘਰਾਂ ਵਿੱਚ ਸਾਰੇ ਕੰਮ ਰੁੱਕ ਜਾਂਦੇ ਹਨ ਕੋਈ ਵੀ ਕੰਮ ਨਹੀਂ ਹੁੰਦਾ ਸਾਰਾ ਕੁਛ ਰੁੱਕ ਜਾਂਦਾ ਹੈ ਖਾਣਾ ਬਣਾਉਣ ਲਈ ਵੀ ਸਾਨੂੰ ਦੇਖਣਾ ਪੈਂਦਾ ਹੈ ਨਾ ਖਾ ਸਕਦੇ ਹਾਂ ਹਨੇਰੇ ਵਿੱਚ ਨਾ ਕੰਮ ਕਰ ਸਕਦੇ ਹਾਂ ਕੋਈ ਹੋਰ ਨਾ ਕੋਈ ਕੱਪੜੇ ਪ੍ਰੈੱਸ ਕਰ ਸਕਦੇ ਹਾਂ ਨਾ ਕੋਈ ਨਾ ਕੋਈ ਹੋਰ ਕੰਮ ਕਰ ਸਕਦੇ ਹਾਂ ਸਾਰੇ ਕੰਮ ਰੁੱਕ ਜਾਂਦੇ ਹਨ ਫਿਰ ਵੈਸੇ ਤਾਂ ਅੱਜ ਕੱਲ੍ਹ ਘੱਟ ਹੀ ਬਿਜਲੀ ਬੰਦ ਹੁੰਦੀ ਹੈ ਪਰ ਜਦੋਂ ਵੀ ਬੰਦ ਹੁੰਦੀ ਹੈ ਤਾਂ ਸਾਰੇ ਲੋਕ ਬਹੁਤ ਪ੍ਰੇਸ਼ਾਨ ਹੁੰਦੇ ਹਨ ਸਾਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ